ਅੰਮ੍ਰਿਤਸਰ ਵਿੱਚ ਸਭ ਤੋਂ ਵੱਧ ਕੇ ਵਿਲੱਖਣ ਜਿਹੜੀ ਕਲਾ ਅਤੇ ਸ਼ਿਲਪਕਾਰੀ ਉਹ ਹੈ ਫੁਲਕਾਰੀ ਫੁਲਕਾਰੀ ਇੱਕ ਦੁਪੱਟਾ ਵਜੋਂ ਵੀ ਅਤੇ ਇੱਕ ਸ਼ੌਲ ਵਜੋਂ ਵੀ ਮੰਨਿਆ ਜਾਂਦਾ ਹੈ ਕੋਈ ਵੀ ਤਿਉਹਾਰ ਹੋਵੇ ਕੋਈ ਸਮਾਗਮ ਹੋਵੇ ਪੰਜਾਬਣਾਂ ਫੁਲਕਾਰੀ ਤੋਂ ਬਿਨਾਂ ਆਪਣੇ ਸ਼ਿੰਗਾਰ ਨੂੰ ਪੂਰਾ ਨਹੀਂ ਸਮਝਦੀਆਂ ਉਹਦੇ ਨਾਲ ਪੰਜਾਬੀ ਜੁੱਤੀ ਪੰਜਾਬੀ ਜੁੱਤੀ ਅਤੇ ਨਾਲ ਫੁਲਕਾਰੀ ਇਹ ਇਨ੍ਹਾਂ ਦੋਵਾਂ ਦੇ ਸੁਮੇਲ ਦਾ ਕਹਿਣਾ ਹੀ ਕਿਆ ਕੋਈ ਪੰਜਾਬਣ ਤੁਹਾਨੂੰ ਕਿਤੇ ਵੀ ਮੇਲੇ ਦੇ ਵਿੱਚ ਕਿਸੇ ਸਮਾਗਮ ਦੇ ਵਿੱਚ ਇਨ੍ਹਾਂ ਦੋਵਾਂ ਦੇ ਬਿਨਾਂ ਨਹੀਂ ਮਿਲੇਗੀ ਬਟ ਅੱਜ ਕੱਲ੍ਹ ਇਸ ਜ਼ਿਲ੍ਹਾ ਜਿਹੜਾ ਹੈ ਆਪਣੇ ਸੱਭਿਆਚਾਰ ਤੋਂ ਕੁਛ ਕੁ ਦੂਰ ਹੁੰਦਾ ਜਾ ਰਿਹਾ ਹੈ ਇੱਥੇ ਜਿਹੜੇ ਟੂਰਿਸਟ ਆ ਰਹੇੇ ਹਨ ਉਹ ਇਨ੍ਹਾਂ ਚੀਜ਼ਾਂ ਨੂੰ ਮੰਗਦੇ ਹਨ ਪਰ ਜਿਹੜੇ ਲੋਕਲ ਲੋਕ ਨੇ ਉਹ ਇਨ੍ਹਾਂ ਚੀਜ਼ਾਂ ਤੋਂ ਥੋੜ੍ਹਾ ਦੂਰੀ ਬਣਾ ਕੇ ਚੱਲ ਰਹੇ ਹਨ ਉਨ੍ਹਾਂ ਨੂੰ ਇਹ ਲੱਗਦਾ ਇਹ ਪੁਰਾਤਨ ਸੱਭਿਆਚਾਰ ਸੀ ਅਸੀਂ ਹੁਣ ਨਵੀਨੀਕਰਨ ਦੇ ਵਿੱਚ ਆ ਗਏ ਹਾਂ ਸਾਨੂੰ ਇਹ ਚੀਜ਼ਾਂ ਸਾਂਭੀਆਂ ਨਹੀਂ ਜਾਣੀਆਂ ਅਤੇ ਪੁਰਾਣੇ ਲੋਕ ਇਨ੍ਹਾਂ ਨੂੰ ਹੁਣ ਆਪਣੇ ਘਰਾਂ ਦੇ ਸੰਦੂਕਾਂ ਵਿੱਚ ਇੱਕ ਖਜ਼ਾਨੇ ਦੇ ਤੌਰ 'ਤੇ ਹੀ ਸੰਭਾਲ ਕੇ ਰੱਖ ਰਹੇ ਹਨ